ਸਮੇਂ ਦੇ ਨਾਲ ਨਾਲ ਜਿਹੜੀ ਖੇਤੀਬਾੜੀ ਆ ਉਹਦੇ ਵਿੱਚ ਵੀ ਕਾਫੀ ਤਬਦੀਲੀਆਂ ਆ ਰਹੀਆਂ ਨੇਗੀਆਂ ਜੇਕਰ ਅਸੀਂ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਜਿਹੜੀਆਂ ਤਕਨੀਕੀ ਤਬਦੀਲੀਆਂ ਨੇ ਉਹ ਆ ਰਹੀਆਂ ਨੇ ਜਿਵੇਂ ਅਸੀਂ ਦੇਖਦੇ ਹਾਂ ਪਹਿਲਾਂ ਜਿਹੜੀ ਖੇਤੀਬਾੜੀ ਦੇ ਵਿੱਚ ਬਿਜਾਈ ਹੈ ਹੈ ਨਾ ਉਹ ਬਲਦਾਂ ਨਾਲ ਕੀਤੀ ਜਾਂਦੀ ਸੀਗੀ ਪਰ ਤਕਨੀਕ ਦੇ ਆਉਣ ਤੋਂ ਬਾਅਦ ਜਿਹੜੀ ਬਲਦਾਂ ਦੀ ਜਗ੍ਹਾ ਉਹ ਟਰੈਕਟਰਾਂ ਨੇ ਲੈ ਲਈ ਹੈ ਜਿੱਥੇ ਦਿਨਾਂ ਵਿੱਚ ਹੋਣ ਵਾਲਾ ਕੰਮ ਘੰਟਿਆਂ ਨਾਲ ਹੋਣ ਲੱਗ ਗਿਆ ਅਤੇ ਘੰਟਿਆਂ ਵਿੱਚ ਹੋਣ ਵਾਲਾ ਕੰਮ ਹੈ ਜਿਹੜਾ ਉਹ ਕੁਛ ਕੋਈ ਮਿੰਟਾਂ ਦੇ ਵਿੱਚ ਹੈ ਜਿਹੜਾ ਉਹ ਖ਼ਤਮ ਹੋਣ ਲੱਗ ਗਿਆ ਅਤੇ ਇਹਦੇ ਨਾਲ ਖੇਤੀ ਦੇ ਵਿੱਚ ਜਿਹੜੀ ਪ੍ਰੋਡਕਸ਼ਨ ਹੈ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਹੈਰਾਨੀਜਨਕ ਵਾਧਾ ਜਿਹੜਾ ਉਹ ਹੋਇਆ ਇਸ ਤੋਂ ਇਲਾਵਾ ਅਗਰ ਅਸੀਂ ਵਾਢੀ ਟਾਈਮ ਦੀ ਗੱਲ ਕਰੀਏ ਤਾਂ ਪਹਿਲਾਂ ਲੋਕ ਹੱਥਾਂ ਨਾਲ ਵੱਢਦੇ ਸੀ ਫਿਰ ਜਿਹੜੇ ਥਰੈਸ਼ਰ ਆ ਉਹ ਆਏ ਉਸ ਤੋਂ ਬਾਅਦ ਥਰੈਸ਼ਰਾਂ ਦੀ ਜਗ੍ਹਾ ਜਿਹੜੀ ਉਹ ਕੰਬਾਈਨਾਂ ਨੇ ਲੈ ਲਈ ਹੁਣ ਕੰਬਾਈਨਾਂ ਦੇ ਨਾਲ ਅਸੀਂ ਕਿੱਲਿਆਂ ਦੇ ਕਿੱਲੇ ਵੱਡੇ ਵੱਡੇ ਜਿਹੜੇ ਖੇਤ ਨੇ ਉਹ ਸ਼ਾਮ ਤੱਕ ਜਾਂ ਕੁਛ ਕੁ ਘੰਟਿਆਂ ਦੇ ਵਿੱਚ ਆ ਜਿਹੜਾ ਉਹ ਵਾਢੀ ਖ਼ਤਮ ਕਰਕੇ ਆਪਣੀ ਜਿਹੜੀ ਫ਼ਸਲ ਆ ਉਹ ਸਾਂਭ ਲੈਂਦੇ ਆਗੇ ਕਿਉਂਕਿ ਇਹਦੇ ਨਾਲ ਮੌਸਮ ਦੀ ਮਾਰ ਹੈ ਜਿਹੜੀ ਉਹ ਵੀ ਫ਼ਸਲ ਦੇ ਉੱਪਰ ਕਾਫੀ ਜ਼ਿਆਦਾ ਘੱਟ ਗਈ ਹੈ